ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਦੱਸੋ ਕਿਹੜੇ ਕਿਹੜੇ ਫੂਡ ਔਡਰ ਕਰਨੇ ਸੀ ਹਾਂਜੀ ਹਾਂਜੀ ਕੋਈ ਨਹੀਂ ਮਿਲਜੂੰਗੇ ਪੰਜ ਸੌ ਦੀ ਹੈ ਹਾਂਜੀ ਹਾਂਜੀ ਕੁਆਲਿਟੀ ਵਧੀਆ ਹੀ ਹੋਊੰਗੀ ਫਿਕਰ ਨਾ ਕਰੋ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਿੱਠੇ ਵਿੱਚ ਕੀ ਚਾਹੀਦਾ ਹਾਂਜੀ ਹਾਂਜੀ ਹੋਜੂਗਾ ਕੋਈ ਨਹੀਂ ਹਾਂਜੀ ਵਟਸਐਪ 'ਤੇ ਕਰ ਦਿਓ ਹਾਂਜੀ ਹਾਂਜੀ ਹਾਂਜੀ ਕੁਆਲਿਟੀ ਵਧੀਆ ਹੀ ਮਿਲੂੰਗੀ ਤੁਹਾਨੂੰ ਓਕੇ ਧੰਨਵਾਦ